ਹੈਲੋ ਮੈਂ ਆਪਣਾ ਆਰਡਰ ਕੀਤਾ ਸੀ ਮਿੰਤਰਾ ਤੋਂ ਚੌਦ੍ਹਾਂ ਨਵੰਬਰ ਦੋ ਹਜ਼ਾਰ ਚੌਵੀ ਨੂੰ ਮੈਂ ਪੈਂਟ ਦਾ ਗਲਤ ਰੰਗ ਆਰਡਰ ਕਰ ਦਿੱਤਾ ਮੈਂ ਬਾਅਦ 'ਚ ਦੇਖਿਆ ਕਿ ਮੈਂ ਕਾਲੀ ਪੈਂਟ ਮੰਗਵਾਉਣੀ ਸੀ ਅਤੇ ਮੈਂ ਨੀਲੀ ਪੈਂਟ ਆਰਡਰ ਕਰਤੀ ਪਲੀਜ ਮੇਰਾ ਇਹ ਆਰਡਰ ਆਉਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਜਾਵੇ ਮੇਰਾ ਆਰਡਰ ਆਈ ਡੀ ਨੰਬਰ ਹੈ ਚਾਰ ਛੇ ਨੌ ਇੱਕ ਦੋ ਤਿੰਨ ਚਾਰ ਮੇਰਾ ਇਹ ਆਰਡਰ ਐਰਸਚੇਂਜ ਕੀਤਾ ਜਾਵੇ ਮੇਰਾ ਇਹ ਆਰਡਰ ਕਾਲੀ ਪੈਂਟ ਭੇਜਿਆ ਜਾਵੇ ਪਲੀਜ਼ ਮੇਰਾ ਇਹ ਆਰਡਰ ਰੱਦ ਕਰਕੇ ਮੇਰਾ ਦੂਜਾ ਆਰਡਰ ਭੇਜਿਆ ਜਾਵੇ